ਪੰਜਾਬੀ ਭਾਸ਼ਾ ਬਹੁਤ ਅਮੀਰ ਅਤੇ ਖੁਸ਼ਹਾਲ ਭਾਸ਼ਾ ਹੈ ਇਸ ਨੂੰ ਬੜੇ ਲੰਬੇ ਸਮੇਂ ਤੋਂ ਸਟੇਟ ਦੀ ਭਾਸ਼ਾ ਦਾ ਦਰਜਾ ਵੀ ਮਿਲ ਚੁੱਕਿਆ ਹੈ ਚਾਹੇ ਇਸ ਲਈ ਸਾਨੂੰ ਬੜੀ ਮਿਹਨਤ ਮੁਸ਼ੱਕਤ ਕਰਨੀ ਪਈ ਸਾਡੇ ਗੁਰੂਆਂ ਪੀਰਾਂ ਦੀ ਇਸ ਭਾਸ਼ਾ ਦੇ ਵਿਰਾਸੀਅਤ ਸੁਰ ਦੇ ਵਿੱਚ ਵੀ ਹੈ ਇਸ ਦੇ ਬੋਲਣ ਦੇ ਅੰਦਾਜ਼ ਦੇ ਵਿੱਚ ਵੀ ਹੈ ਅਤੇ ਪੰਜਾਬੀ ਨੂੰ ਅਜੇ ਤੱਕ ਜਿਉਂਦਾ ਰੱਖਣ ਵਿੱਚ ਇਸ ਦੇ ਵਾਕੰਸ਼ਾਂ ਨੇ ਇਸ ਦੀ ਮੁਹਾਵਰੇਦਾਰ ਨੇ ਇਸ ਦੇ ਵਿੱਚ ਅਖਾਣਾਂ ਦੀ ਭਰਪੂਰ ਮਾਤਰਾ ਨੇ ਇਸ ਨੂੰ ਲਗਾਤਾਰ ਜਿਉਂਦਾ ਰੱਖਿਆ ਹੈ ਇਸ ਦਾ ਲਗਾਤਾਰ ਵਿਕਾਸ ਕੀਤਾ ਹੈ ਪੰਜਾਬੀ ਭਾਸ਼ਾ ਦੇ ਵਿੱਚ ਹਮੇਸ਼ਾ ਤੋਂ ਇਹਨਾਂ ਵਾਕਾਂ ਦੀ ਇਹਨਾਂ ਵਾਕਾਂਸ਼ਾਂ ਦੀ ਮੁਹਾਵਰਿਆਂ ਦੀ ਅਖਾਣਾਂ ਦੀ ਵਰਤੋਂ ਕੀਤੀ ਜਾਂਦੀ ਹੈ ਮੁਹਾਵਰਿਆਂ ਦੀ ਵਰਤੋਂ ਰਾਹੀਂ ਅਸੀਂ ਆਪਣੀ ਗੱਲ ਨੂੰ ਬੜੀ ਠੁਕਦਾਰ ਬੜੀ ਵਧੀਆ ਤਰੀਕੇ ਨਾਲ ਪੇਸ਼ ਕਰ ਸਕਦੇ ਹਨ ਇਸ ਲਈ ਪੰਜਾਬੀ ਦੇ ਵਿੱਚ ਮੁਹਾਵਰਿਆਂ ਦੀ ਭਰਮਾਰ ਹੈ ਜਿਹਨਾਂ ਵਿੱਚੋਂ ਅਸੀਂ ਕੁਝ ਮੁਹਾਵਰੇ ਇੱਥੇ ਸੁਣ ਸਕਦੇ ਹਾਂ ਜਿਵੇਂ ਉੱਚਾ ਸਾਹ ਨਾ ਕੱਢਣਾ ਉਸਤਾਦੀ ਕਰਨੀ ਉਂਗਲੀ ਕਰਨੀ ਉਲਟੀ ਪੱਟੀ ਪੜਾਉਣੀ ਅੱਖਾਂ ਦਿਖਾਉਣਾ ਅੱਖਾਂ ਵਿੱਚ ਰੜਕਣਾ ਊਂਠ ਦੇ ਮੂੰਹ 'ਚ ਜੀਰਾ ਸਾਹ ਸੱਤ ਹੋਣਾ ਹੱਥ ਪੀਲੇ ਕਰਨਾ ਹੱਥਾਂ ਪੈਰਾਂ 'ਚ ਆ ਜਾਣਾ ਸਭ ਨੂੰ ਇੱਕ ਅੱਖ ਨਾਲ ਵੇਖਣਾ ਮਹਾਰਾਜਾ ਰਣਜੀਤ ਸਿੰਘ ਬਾਰੇ ਇਹ ਮੁਹਾਵਰਾ ਆਮ ਵਰਤਿਆ ਜਾਂਦਾ ਜਦੋਂ ਵੀ ਉਹ ਉਸ ਰਾਜ ਦੀ ਗੱਲ ਕੀਤੀ ਜਾਂਦੀ ਤਾਂ ਇਹ ਮੁਹਾਵਰਾ ਵਰਤਿਆ ਜਾਂਦਾ ਕਿ ਮਹਾਰਾਜਾ ਰਣਜੀਤ ਸਿੰਘ ਸਭ ਨੂੰ ਇੱਕ ਅੱਖ ਨਾਲ ਵੇਖਦੇ ਸੀ ਯਾਨੀ ਕਿ ਉਹ ਸਭ ਨੂੰ ਸਮਾਨ ਨਜ਼ਰਾਂ ਨਾਲ ਦੇਖਦੇ ਸੀ ਉਹ ਕਿਸੇ ਵੀ ਮਨੁੱਖ ਨਾਲ ਉਸ ਦੀ ਭਾਸ਼ਾ ਉਸ ਦੀ ਜਾਤ ਨਸਲ ਜਾਂ ਧਰਮ ਕਰਕੇ ਵਿਤਕਰਾ ਨਹੀਂ ਕਰਦੇ ਸੀ ਇਸ ਲਈ ਇਹ ਮੁਹਾਵਰਾ ਉਸ ਸਮੇਂ ਤੋਂ ਹੀ ਪ੍ਰਚਲਿਤ ਹੈ ਕਿ ਮਹਾਰਾਜਾ ਰਣਜੀਤ ਸਿੰਘ ਸਭ ਨੂੰ ਇੱਕ ਅੱਖ ਨਾਲ ਦੇਖਦੇ ਸਨ